ਸਾਨੂੰ ਦਿਨ ਦੇ ਦੌਰਾਨ ਪਾਣੀ ਦੀ ਬਹੁਤ ਲੋੜ ਪੈਂਦੀ ਹੈ ਸਭ ਤੋਂ ਪਹਿਲਾਂ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਬੁਰਸ਼ ਕਰਨ ਲਈ ਵੀ ਸਾਨੂੰ ਪਾਣੀ ਚਾਹੀਦਾ ਹੈ ਫਿਰ ਜਦੋਂ ਅਸੀਂ ਨਹਾਉਣ ਜਾਂਦੇ ਹਾਂ ਉਸ ਨਹਾਉਣ ਲਈ ਵੀ ਸਾਨੂੰ ਪਾਣੀ ਦੀ ਬਹੁਤ ਹੀ ਲੋੜ ਹੈ ਉਸ ਤੋਂ ਬਾਅਦ ਅਸੀਂ ਜਦੋਂ ਘਰ ਦਾ ਕੰਮ ਕਰਦੇ ਹਾਂ ਜਿਵੇਂ ਕਿ ਪੋਚਾ ਲਗਾਉਣਾ ਕੱਪੜੇ ਧੋਣੇ ਭਾਂਡੇ ਮਾਂਜਣੇ ਅਤੇ ਹੋਰ ਵੀ ਅਜਿਹੇ ਕੰਮ ਹਨ ਜਿਨ੍ਹਾਂ ਨੂੰ ਕਰਨ ਲਈ ਅਸੀਂ ਪਾਣੀ ਦੀ ਵਰਤੋਂ ਕਰਦੇ ਹਾਂ ਸਭ ਤੋਂ ਜ਼ਰੂਰੀ ਪਾਣੀ ਨਾਲ਼ ਅਸੀਂ ਜੀ ਰਹੇ ਹਾਂ ਸਾਨੂੰ ਪਾਣੀ ਦੀ ਬੱਚਤ ਕਰਨੀ ਚਾਹੀਦਾ ਹੈ ਚਾਹੀਦੀ ਹੈ ਉਸ ਤੋਂ ਬਾਅਦ ਜਦੋਂ ਅਸੀਂ ਰੋਟੀ ਬਣਾਉਂਦੇ ਹਾਂ ਰੋਟੀ ਬਣਾਉਣ ਲਈ ਆਟਾ ਗੁੰਦਾ ਗੁੰਨ੍ਹਣਾ ਪੈਂਦਾ ਆਟਾ ਗੁੰਨ੍ਹਣ ਤੋਂ ਪਹਿਲਾਂ ਅਸੀਂ ਆਟੇ ਵਿੱਚ ਵੀ ਪਾਣੀ ਪਾਉਂਦੇ ਹਾਂ ਅਤੇ ਪਾਣੀ ਨਾਲ਼ ਹੀ ਸਾਡਾ ਆਟਾ ਗੁੰਨ੍ਹਿਆ ਜਾਂਦਾ ਹੈ ਇਸ ਕਰਕੇ ਸਾਡੀ ਰੋਟੀ ਤਿਆਰ ਹੁੰਦੀ ਹੈ ਉਸ ਤੋਂ ਬਾਅਦ ਸਬਜ਼ੀ ਬਣਾਉਣ ਲਈ ਵੀ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਜਿਵੇਂ ਕਿ ਦਾਲ ਮਤਲਬ ਕਈ ਤਰ੍ਹਾਂ ਦੀਆਂ ਦਾਲਾਂ ਹੋ ਗਈਆਂ ਰਾਜਮਾਂਹ ਹੋਰ ਵੀ ਐਦਾਂ ਦੀਆਂ ਚੀਜ਼ਾਂ ਜਿਹਨਾਂ ਵਿੱਚ ਪਾਣੀ ਦੀ ਬਹੁਤ ਲੋੜ ਹੈ ਉਸ ਤੋਂ ਬਾਅਦ ਅਸੀਂ ਰੋਟੀ ਖਾਣ ਤੋਂ ਪਹਿਲਾਂ ਵੀ ਪਾਣੀ ਨਾਲ਼ ਹੱਥ ਸਾਫ਼ ਕਰਦੇ ਹਾਂ ਰੋਟੀ ਖਾਣ ਤੋਂ ਬਾਅਦ ਵੀ ਪਾਣੀ ਨਾਲ਼ ਹੱਥ ਧੋਂਦੇ ਹਾਂ ਉਸ ਤੋਂ ਬਾਅਦ ਸਾਡੀ ਖੇਤਾਂ ਵਿੱਚ ਉੱਥੇ ਵੀ ਪਾਣੀ ਦੀ ਬਹੁਤ ਹੀ ਲੋੜ ਹੈ ਜਦੋਂ ਅਸੀਂ ਕੋਈ ਸਬਜ਼ੀ ਲਗਾਉਂਦੇ ਹਾਂ ਜਾਂ ਅਸੀਂ ਖੇਤਾਂ ਵਿੱਚ ਕੋਈ ਵੀ ਝੋਨਾ ਕਣਕ ਲਗਾਉਂਦੇ ਹਾਂ ਉਹਨਾਂ ਲਈ ਵੀ ਸਾਨੂੰ ਪਾਣੀ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਇਸ ਕਰਕੇ ਸਾਨੂੰ ਪਾਣੀ ਦੀ ਵਰਤੋਂ ਬਹੁਤ ਹੀ ਹਿਸਾਬ ਨਾਲ਼ ਚੰਗੇ ਤਰੀਕੇ ਨਾਲ਼ ਕਰਨੀ ਚਾਹੀਦੀ ਹੈ ਸਾਨੂੰ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ ਧੰਨਵਾਦ